ਪਸ਼ੂ ਭਲਾਈ ਭਾਰਤ ਵਿੱਚ ਪਸ਼ੂ ਕਲਿਆਣ ਕਾਨੂੰਨ ਪਸ਼ੂਆਂ ਨੂੰ ਵਧੀਆ ਖਾਣ ਪੀਣ ਅਤੇ ਰਹਿਣ ਦੀ ਵਿਵਸਥਾ ਅਤੇ ਲਾਜ਼ਮੀ ਬਿਮਾਰ ਪਸ਼ੂਆਂ ਦੀ ਉਚਿਤ ਦੇਖਭਾਲ ਅਤੇ ਇਲਾਜ ਪਸ਼ੂਆਂ ਦੀ ਵਿਕਰੀ ਅਤੇ ਖਰੀਦ ਪ੍ਰੋਗਤ ਨਾਲ ਜੁੜੇ ਨਿਯਮ ਪਸ਼ੂ ਮੰਡੀ 'ਚ ਪਸ਼ੂਆਂ ਦੀ ਹਾਲਤ ਨੂੰ ਲੈ ਕੇ ਨਿਯਮ ਟਰਾਂਸਪੋਰਟ ਦੇ ਦੌਰਾਨ ਪਸ਼ੂਆਂ ਨਾਲ ਕੁੜਤਰਾ ਨਾ ਹੋਵੇ ਇਸ ਲਈ ਨਿਰਦੇਸ਼ ਵਾਤਾਵਰਨ ਅਤੇ ਸਿਹਤ ਸੰਬੰਧੀ ਨਿਯਮ ਪਸ਼ੂ ਪਾਲਣ ਨਾਲ ਨਿਕਲਣ ਵਾਲੀਆਂ ਗੰਦੀਆਂ ਨਿਕਾਸਾਂ ਨੂੰ ਠੀਕ ਢੰਗ ਨਾਲ ਨਿਪਟਾਉਣ ਦੀ ਲੋੜ ਵਾਈਟ ਵੇਸਟ ਨਿਪਟਾਰਾ ਨਿਯਮ ਪਸ਼ੂਆਂ ਦੇ ਮਲ ਮੂਤਰ ਅਤੇ ਹੋਰ ਜੈਵਿਕ ਅਵਿਸ਼ੇਸ਼ਾਂ ਦਾ ਸਹੀ ਨਿਪਟਾਰਾ ਪਸ਼ੂਆਂ ਦੀ ਸਿਹਤ ਸੰਬੰਧੀ ਨਿਯਮ ਪਸ਼ੂਆਂ ਦੇ ਸਮਕਰਮ ਤੋਂ ਬਚਾਅ ਲਈ ਟੀਰਾਕਰਨ ਪਸ਼ੂਆਂ ਦੀ ਬਿਮਾਰੀ ਦੀ ਜਾਣਕਾਰੀ ਸਥਾਨਕ ਪਸ਼ੂ ਪਾਲਣ ਵਿਭਾਗ ਨੂੰ ਦੇਣੀ ਉਤਪਾਦਾਂ ਦੀ ਚੈਕਿੰਗ ਲਈ ਸਰਕਾਰੀ ਨਿਯਮਾਂ ਦੀ ਪਾਲਣਾ ਕਿਸਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਰ ਸਰਕਾਰ ਵੱਲੋਂ ਪਸ਼ੂ ਪਾਲਣ ਲਈ ਮਿਲਣ ਵਾਲੀਆਂ ਸਹੂਲਤਾਂ ਅਤੇ ਆਰਥਿਕ ਮਦਦ ਨਵੀਂ ਤਕਨੀਕ ਅਤੇ ਵਿਗਿਆਨਕ ਪੱਧਰ 'ਤੇ ਸਹਾਇਤਾ ਕਾਨੂੰਨੀ ਮਾਮਲੇ ਜੇ ਕਿਸਾਨ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਹਨਾਂ ਨੂੰ ਜੁਰਮਾਨਾ ਜਾਣ ਸਜ਼ਾ ਹੋ ਸਕਦੀ ਹੈ ਨਵੇਂ ਨਿਯਮ ਕਿਸਾਨਾਂ ਦੇ ਖਰਚੇ ਅਤੇ ਪਾਲਣ ਦੇ ਤਰੀਕਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ